ਮੇਰੇ ਦੁਆਰਾ ਡਾਊਨਲੋਡ ਕੀਤੀ ਗਈ ਆਖਰੀ ਐਪ ਵਟਸਅਪ ਹੈ ਇਸ ਐਪ ਵਿੱਚ ਅਸੀਂ ਸੁਨੇਹਾ ਵੀਡੀਓ ਕਾਲ ਫੋਟੋ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ ਮੈਂ ਆਪਣੇ ਫੋਨ 'ਤੇ ਆਮ ਤੌਰ 'ਤੇ ਸਟਡੀ ਐਪ ਦੀ ਵਰਤੋਂ ਕਰਦੀ ਹਾਂ ਮੈਂ ਇਹਨਾਂ ਐਪ ਤੋਂ ਸਿੱਖਿਆ ਲੈਂਦੀ ਹਾਂ ਇਹ ਐਪ ਮੇਰੇ ਗਿਆਨ ਵਿੱਚ ਵਾਧਾ ਕਰਦਾ ਹੈ